ਮੈਂ ਬਾਰ੍ਹਾਂ ਸਾਲਾਂ ਦੀ ਉਮਰ ਵਿੱਚ ਪੜ੍ਹਾਈ ਲਿਖਾਈ ਦਾ ਕੰਮ ਛੱਡ ਦਿੱਤਾ ਅਤੇ ਮੇਰੀ ਮੰਮੀ ਦੇ ਕੰਮਾਂ ਵੱਲ ਹੱਥ ਵਟਾਉਣ ਲੱਗ ਪਈ ਮੇਰੀ ਮੰਮੀ ਦੇ ਕ ਕੰਮ ਸਿਲਾਈ ਦਾ ਕਰਦੀ ਸੀ ਉਹਨੇ ਮੈਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਅਸੀਂ ਸਵੇਰੇ ਜਲਦੀ ਉੱਠਦੀਆਂ ਅਤੇ ਉੱਠ ਕੇ ਪਾਠ ਪੂਜਾ ਵੀ ਕਰਦੀਆਂ ਅਤੇ ਫੇਰ ਆਪਦੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਟਿਫਨ ਵਗੈਰਾ ਬਣਾਉਣੇ ਭਰਜਾਈਆਂ ਨੇ ਵੀ ਮੇਰਾ ਸਾਥ ਦਿੱਤਾ ਉਹਨਾਂ ਨੇ ਵੀ ਜਲਦੀ ਉੱਠ ਕੇ ਆਪਣੇ ਘਰ ਦਾ ਕੰਮ ਨਿਪਟਾਉਂਦੀਆਂ ਸਨ ਫਿਰ ਅਸੀਂ ਨੌਂ ਵਜੇ ਸਿਲਾਈ ਕਢਾਈ ਬੁਣਾਈ ਦਾ ਕੰਮ ਕਰਦੀਆਂ ਅਤੇ ਮੰਮੀ ਮੇਰੀ ਸਿਲਾਈ ਦਾ ਕੰਮ ਕਰਦੀ ਸੀ ਮੈਂ ਉਹਨਾਂ ਨੂੰ ਵੇਖ ਵੇਖ ਕੇ ਆਪਣੇ ਸਿਲਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਅੱਗੇ ਵਧਦੀ ਰਹੀ ਅਤੇ ਮੇਰੀਆਂ ਭਰਜਾਈਆਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਦਰੀਆਂ ਬਣਾਉਂਦੀਆਂ ਅਤੇ ਮੈਨੂੰ ਵੀ ਕਰੋਸ਼ੀਆ ਨਾਲੇ ਹੀ ਕਰੋਸ਼ੀਆ ਸਿਖਾ ਦਿੰਦੀਆਂ ਮੇਰੀ ਦਾਦੀ ਮੈਨੂੰ ਕਰੋਸ਼ੀਆ ਸਿਖਾਉਂਦੀ ਹੁੰਦੀ ਸੀ ਅਤੇ ਇੰਨੇ ਨਾਲ ਸਾਡਾ ਕੰਮ ਕਾਰ ਵਧਦਾ ਰਿਹਾ ਹੌਲੀ ਹੌਲੀ ਅਸੀਂ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਬਾਹਰਲੇ ਕੰਮ ਵੀ ਫੜਨੇ ਸ਼ੁਰੂ ਕਰ ਦਿੱਤੇ ਸਿਲਾਈ ਦਾ ਕੰਮ ਸਾਨੂੰ ਬਾਹਰੋਂ ਆਉਣ ਲੱਗ ਪਿਆ ਅਤੇ ਅਸੀਂ ਹੌਲੀ ਹੌਲੀ ਕੰਮ ਕਰਦੀਆਂ ਰਹੀਆਂ ਅਤੇ ਬੁਟੀਕ ਖੋਲ੍ਹਣੇ ਸ਼ੁਰੂ ਬੁਟੀਕ ਕਰਨੇ ਸ਼ੁਰੂ ਕਰ ਦਿੱਤੇ ਅਤੇ ਬੁਟੀਕ ਦਾ ਕੰਮ ਹੌਲੀ ਹੌਲੀ ਵਧਦਾ ਰਿਹਾ ਫੇਰ ਅਸੀਂ ਅਸੀਂ ਹੌਲੀ ਹੌਲੀ ਕਰੋਸ਼ੀਏ ਦਾ ਕੰਮ ਸ਼ੁਰੂ ਕਰ ਦਿੱਤਾ ਅਸੀਂ ਅਤੇ ਦੁਪਹਿਰੇ ਅਸੀਂ ਰੋਟੀ ਪਾਣੀ ਖਾ ਕੇ ਚਾਰ ਵਜੇ ਫੇਰ ਸ਼ੁਰੂ ਕਰ ਦਿੰਦੀਆਂ ਅਤੇ ਮੇਰੀਆਂ ਭਰਜਾਈਆਂ ਵੀ ਮੇਰੇ ਨਾਲ ਵੀ ਕੰਮ ਵਿੱਚ ਹੱਥ ਵਟਾਉਂਦੀਆਂ ਅਤੇ ਮੈਨੂੰ ਕੰਮ ਵਿੱਚ ਹੌਂਸਲਾ ਦਿੰਦੀਆਂ ਅਤੇ ਫੇਰ ਅਸੀਂ ਭਰਜਾਈਆਂ ਨੇ ਦਰੀਆਂ ਬਣਾਉਂਦੀਆਂ ਮੈਂ ਸਿਲਾਈ ਅਤੇ ਕਢਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਹਰਲੇ ਓਰਡਰ ਲੈਣੇ ਸ਼ੁਰੂ ਕਰ ਦਿੱਤੇ ਫੇਰ ਅਸੀਂ ਬਾਹਰਲੇ ਓਰਡਰ ਮੇਰੀ ਮੰਮੀ ਬਾਹਰੋਂ ਲੈ ਕੇ ਆਉਂਦੀ ਅਤੇ ਮੈਂ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਅਸੀਂ ਕਢਾਈ ਕੱਢਣ ਲੱਗ ਪਏ ਸੂਟਾਂ ਦੀ ਕਢਾਈ ਕੱਢਦੇ ਕੱਢਦੇ ਸਾਨੂੰ ਓਰਡਰ ਆਉਣ ਲੱਗ ਪਏ ਅਤੇ ਅਸੀਂ ਕਢਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਢਾਈ ਦੇ ਓਰਡਰ ਬਾਹਰੋਂ ਲੈ ਕੇ ਆਉਣੇ ਅਤੇ ਅਸੀਂ ਸਾਰਿਆਂ ਨੇ ਕੱਟਵਰਕ ਦੀ ਕਢਾਈ ਕਰਨੀ ਅਤੇ ਇੰਨੇ ਨਾਲ ਸਾਡਾ ਕੰਮ ਕਾਰ ਵਿੱਚ ਵਾਧੇ ਹੁੰਦੇ ਗਏ ਅਤੇ ਭਰਜਾਈਆਂ ਨੇ ਵੀ ਸਾਡਾ ਸਾਥ ਪੂਰਾ ਦਿੱਤਾ ਅਤੇ ਇੰਨੇ ਨਾਲ ਸਾਡੇ ਪਰਿਵਾਰ ਵਿੱਚ ਏਕਤਾ ਬਣ ਗਈ